ਚਿੱਤਰਕਾਰੀ ਲੋਕਾਂ ਲਈ ਬਹੁਤ ਜ਼ਿਆਦਾ ਲਾਭਕਾਰੀ ਹੋ ਸਕਦੀ ਹੈ ਜਦੋਂ ਲੋਕ ਦਿਲ ਲਗਾ ਕੇ ਕੰਮ ਕਰਦੇ ਹਨ ਤਾਂ ਇਹ ਉਹਨਾਂ ਦੇ ਪੈਸੇ ਕਮਾਉਣ ਦਾ ਵੀ ਵਧੀਆ ਸਾਧਨ ਹੈ ਚਿੱਤਰਕਾਰੀ ਨਾਲ ਇਨਸਾਨ ਵਿੱਚ ਅਨੁਸ਼ਾਸਨ ਆਉਂਦਾ ਹੈ ਇਸ ਨਾਲ ਸੰਗਾਟ ਸੰਗਡਾ ਸੰਖਟ ਨਾ ਇਨਸਾਨ ਦੇ ਹੁਨਰ ਦਾ ਵਿਕਾਸ ਹੁੰਦਾ ਹੈ ਇਸ ਨਾਲ ਕਲਪਨਾ ਸ਼ਕਤੀ ਵੱਧਦੀ ਹੈ ਰਤਨਾਤਮਕ ਰਚਨਾਤਮਕਤਾ ਆਉਂਦੀ ਹੈ ਪਿੱਛੇ ਜਿਹੇ ਮੈਂ ਚੰਡੀਗੜ੍ਹ ਸ਼ਹਿਰ ਘੁੰਮਣ ਗਈ ਸੀ ਉਦੋਂ ਇੱਕ ਬੰਦਾ ਪੈਸੇ ਲੈ ਕੇ ਚਿੱਤਰਕਾਰੀ ਬਣਾ ਰਿਹਾ ਸੀ ਉਹ ਚਿੱਤਰਕਾਰੀ ਦੇ ਬਦਲੇ ਉਹਨਾਂ ਤੋਂ ਇੱਕ ਚੰਗੀ ਅਤੇ ਮੋਟੀ ਰਕਮ ਲੈ ਰਿਹਾ ਸੀ ਚਿੱਤਰਕਾਰੀ ਇੱਕ ਬਹੁਤ ਵਧੀਆ ਰੁਜ਼ਗਾਰ ਦਾ ਸਾਧਨ ਵੀ ਹੈ ਜਿਸ ਬੰਦੇ ਦੀ ਚਿੱਤਰਕਾਰੀ ਵਧੀਆ ਹੁੰਦੀ ਹੈ ਉਹ ਟੈਟੂ ਵੀ ਆਸਾਨੀ ਨਾਲ ਬਣਾਉਣੇ ਸਿੱਖ ਜਾਂਦਾ ਹੈ ਜਿਸ ਨਾਲ ਉਹ ਵਧੀਆ ਪੈਸੇ ਵੀ ਕਮਾ ਲੈਂਦਾ ਹੈ ਅਤੇ ਬਾਹਰਲੇ ਦੇਸ਼ਾਂ ਵਿੱਚ ਵੀ ਇਸਦੀ ਬਹੁਤ ਡਿਮਾਂਡ ਹੁੰਦੀ ਹੈ ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਚਿੱਤਰਕਾਰੀ ਲੋਕਾਂ ਲਈ ਬਹੁਤ ਲਾਭਕਾਰੀ ਹੋ ਸਕਦੀ ਹੈ ਅਤੇ ਇਸ ਦੇ ਬਹੁਤ ਸਾਰੇ ਫਾਇਦੇ ਬੰਦਾ ਆਪਣੀਆਂ ਕਲਪਨਾਵਾਂ ਦੇ ਨਜ਼ਰੀਏ ਇਸ ਨੂੰ ਚਿੱਤਰਕਾਰੀ ਨਾਲ ਆਪਣੀਆਂ ਯਾਦਾਂ ਨੂੰ ਸਾਂਭ ਕੇ ਰੱਖ ਸਕਦਾ ਹੈ